ਮੇਰਾ ਨਾਮ ਮੋਨੀਕਾ ਹੈ ਮੈਂ ਤੁਹਾਨੂੰ ਅੱਜ ਸਾਰਿਆਂ ਨੂੰ ਸਿਹਤ ਅਤੇ ਤੰਦਰੁਸਤੀ ਲਈ ਤੈਰਾਕੀ ਜਿਵੇਂ ਕਿ ਤੈਰਨੇ ਬਾਰੇ ਕੁਝ ਗੱਲਾਂ ਦੱਸਣਾ ਚਾਹੁੰਦੀ ਹੈ ਇਸ ਨਾਲ ਸਾਡਾ ਸ਼ਰੀਰ ਵਧੀਆ ਰਹਿੰਦਾ ਹੈ ਸਾਨੂੰ ਸਾਹ ਲੈਣ ਵਿੱਚ ਵੀ ਕੋਈ ਵੀ ਦਿੱਕਤ ਨਹੀਂ ਆਉਂਦੀ ਇਸ ਨਾਲ ਸਾਡੇ ਸਰੀਰ ਵਿਧੀ ਸਾਹ ਲੈਣ ਦੀ ਸ਼ਕਤੀ ਵੀ ਵੱਧ ਜਾਂਦੀ ਹੈ ਅਤੇ ਇਸ ਨਾਲ ਸਾਡੇ ਹੱਥ ਪੈਰ ਵੀ ਚੰਗੀ ਤਰ੍ਹਾਂ ਕੰਮ ਕਰਦੇ ਹਨ ਸਾਨੂੰ ਤੈਰ ਕੇ ਆਪਣੇ ਆਪ ਨੂੰ ਇੱਕ ਬਹੁਤ ਵਧੀਆ ਚੰਗੀ ਤਰ੍ਹਾਂ ਚੀਜ਼ ਮਹਿਸੂਸ ਹੁੰਦੀ ਹੈ ਤੈਰਾਕੀ ਕਰਨ ਨਾਲ ਸਾਡੇ ਸ਼ਰੀਰ ਦੀ ਪਾਚਨ ਸ਼ਕਤੀ ਵੀ ਵੱਧ ਜਾਂਦੀ ਹੈਂ ਅਤੇ ਸਾਨੂੰ ਜ਼ਿਆਦਾ ਭੁੱਖ ਵੀ ਲੱਗਦੀ ਹਨ ਅਤੇ ਸਾਡਾ ਸ਼ਰੀਰ ਵੀ ਤੰਦਰੁਸਤ ਰਹਿੰਦਾ ਹੈ ਇਸ ਨਾਲ ਹੱਥ ਕੰਮ ਕਰਨ ਤੋਂ ਕਦੇ ਵੀ ਨਹੀਂ ਥੱਕਦੇ ਅਤੇ ਸਾਡੇ ਸਰੀਰ ਦੇ ਹੱਥ ਪੈਰ ਚੰਗੀ ਤਰ੍ਹਾਂ ਕੰਮ ਕਰਨ ਵਿੱਚ ਸਹਾਇਤਾ ਕਰਦੇ ਰਹਿੰਦੇ ਹਨ ਅਤੇ ਅਸੀਂ ਸਾਡੇ ਅਤੇ ਅਸੀਂ ਸਾਰੇ ਜਣੇ ਫਿੱਟ ਮਹਿਸੂਸ ਕਰਦੇ ਹਨ ਆਪਣੇ ਆਪ ਨੂੰ ਨਾ ਸਾਨੂੰ ਜ਼ਿਆਦਾ ਮੋਟਾਪਨ ਮਹਿਸੂਸ ਹੁੰਦਾ ਅਤੇ ਨਾ ਹੀ ਸਾਨੂੰ ਕਦੇ ਵੀ ਕੋਈ ਬਿਮਾਰੀ ਲੱਗਦੀ ਹੈ ਇਹ ਸਾਡੇ ਸ਼ਰੀਰ ਲਈ ਬਹੁਤ ਹੀ ਲਾਭਦਾਇਕ ਹੁੰਦਾ ਹੈ